ਲੋਕ ਵਿਆਹ 'ਤੇ ਲਾੜੀ ਨੂੰ ਤੋਹਫੇ ਵਿੱਚ ਦਿੰਦੇ ਹਨ ਜਿਵੇਂ ਕਿ ਸੀਨਰੀ ਵਗੈਰਾ ਹੋ ਗਈ ਅਤੇ ਕੋਈ ਸਜਾਵਟੀ ਚੀਜ਼ ਹੋ ਗਈ ਜਿਵੇਂ ਫੁੱਲ ਹੋਗੇ ਜਾਂ ਗੁਲਦਸਤਾ ਵਗੈਰਾ ਹੋ ਗਿਆ ਅਤੇ ਕਈ ਦੇ ਦਿੰਦੇ ਵੀ ਭਾਂਡੇ ਵਗੈਰਾ ਫੋਟੋ ਫਰੇਮ ਐਵੇਂ ਦੇ ਹੀ ਤੋਹਫੇ ਦੇਣੇ ਵਧੀਆ ਲੱਗਦੇ ਆ ਜੇ ਦਾਜ ਸਾਡੇ ਕਨੀ ਦਾਜ ਦੀ ਪ੍ਰਥਾ ਬਿਲਕੁਲ ਹੀ ਖਤਮ ਜਿਹਨੂੰ ਵਧ ਵਧਾਉਣਾ ਬਹੁਤ ਹੀ ਗ਼ਲਤ ਹੈ ਅਤੇ ਉਹਨੂੰ ਉੱਥੇ ਹੀ ਖਤਮ ਕਰ ਦੇਣਾ ਚਾਹੀਦਾ ਇਹ ਅੱਗੇ ਤੋਂ ਅੱਗੇ ਵੱਧਦਾ ਅਤੇ ਆਪਣੀਆਂ ਬੇਟੀਆਂ 'ਤੇ ਬੁਰਾ ਅਸਰ ਵੀ ਅੱਗੇ ਜਾ ਕੇ ਪੈਂਦਾ ਧੰਨਵਾਦ